ਭੰਗੜਾ ਐਰੋਬਿਕਸ ਮੈਂ ਆਪਣੇ ਬੱਚਿਆਂ ਕੋਲੋਂ ਸੁਣਿਆ ਮੇਰੇ ਬੱਚੇ ਬੜਾ ਹੀ ਕਰਦੇ ਹੈ ਅਤੇ ਮੈਂ ਆਪਣੇ ਪੋਤੇ ਪੋਤਿਆਂ ਕੋਲੋਂ ਸਾਡੇ ਨਾਲ ਦੇ ਪੜੋਸੀਆਂ ਦਾ ਵੀ ਬੇਟਾ ਭੰਗੜਾ ਬਹੁਤ ਕਰਦਾ ਹੈ ਮੈਂ ਉਹਨੂੰ ਵੀ ਦੇਖਿਆ ਕਿ ਭੰਗੜਾ ਕੀਤੇ ਨੂੰ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਭੰਗੜਾ ਐਰੋਬਿਕਸ ਹੀ ਹੈ ਭੰਗੜਾ ਹੀ ਇੱਕ ਅਲੱਗ ਤਰ੍ਹਾਂ ਦਾ ਐਰੋਬਿਕਸ ਮਿਊਜ਼ਿਕ ਬਣਿਆ ਹੋਇਆ ਹੈ ਇਹਦੇ ਵਿੱਚ ਇੱਕ ਅਲੱਗ ਹੀ ਸਰੂਰ ਹੈ ਇਹਨੂੰ ਦੇਖ ਕੇ ਬਹੁਤ ਅੱਛਾ ਲੱਗਦਾ ਜਦੋਂ ਭੰਗੜਾ ਐਰੋਬਿਕਸ ਸੁਣਦੇ ਵੀ ਹੋਰ ਤਾਂ ਇੰਨਾ ਹੀ ਆਰਾਮ ਮਿਲਦਾ ਹੈ ਇਸਨੂੰ ਦੇਖ ਕੇ ਬਹੁਤ ਅੱਛਾ ਮਹਿਸੂਸ ਹੁੰਦਾ ਰਹਿੰਦਾ ਹੈ ਭੰਗੜਾ ਐਰੋਬਿਕਸ ਕਰਨ ਨਾਲ ਇੱਕ ਤਰ੍ਹਾਂ ਸਰੀਰ ਪੂਰੀ ਤਰ੍ਹਾਂ ਨਾਲ ਹਿੱਲ ਜਾਂਦਾ ਹੈ ਭੰਗੜਾ ਐਰੋਬਿਕਸ ਕਰਨ ਨਾਲ ਸਰੀਰ 'ਚ ਇੱਕ ਕਈ ਤਰ੍ਹਾਂ ਦੀਆਂ ਮੂਮੈਂਟਸ ਹੁੰਦੀਆਂ ਰਹਿੰਦੀਆਂ ਹਨ ਭੰਗੜਾ ਐਰੋਬਿਕਸ ਮੇਰੇ ਪੋਤੇ ਪੋਤੀਆਂ ਬਹੁਤ ਜ਼ਿਆਦਾ ਹਾ ਕਰਦੇ ਆ ਅੱਜ ਕੱਲ੍ਹ ਇਹਦਾ ਬਹੁਤ ਜ਼ਿਆਦਾ ਚੱਲਣ ਹੋ ਗਿਆ ਭੰਗੜਾ ਐਰੋਬਿਕਸ ਇੱਕ ਬਹੁਤ ਅੱਛਾ ਹੀ ਡਾਂਸ ਹੈ ਭੰਗੜਾ ਐਰੋਬਿਕਸ ਇੱਕ ਬਹੁਤ ਵਧੀਆ ਹੀ ਨਵੀਂ ਤਕਨੀਕ ਚੱਲੀ ਹੈ ਜਿਹਨੂੰ ਦੇਖ ਕੇ ਬਹੁਤ ਸੋਹਣਾ ਇਹ ਲੱਗਦਾ ਹੈ ਭੰਗੜਾ ਐਰੋਬਿਕਸ ਇੱਕ ਬੱਚੇ ਇਸਨੂੰ ਬਹੁਤ ਜ਼ਿਆਦਾ ਹੀ ਪਸੰਦ ਕਰਦੇ ਹਨ ਅੱਜ ਕੱਲ੍ਹ ਬੱਚਿਆਂ ਦਾ ਇਹ ਬਹੁਤ ਜ਼ਿਆਦਾ ਹੀ ਇਹਦੇ ਵਿੱਚ ਰੁਝਾਨ ਹੋ ਗਿਆ ਹੈ ਬੱਚਿਆਂ ਲਈ ਇਹ ਬਹੁਤ ਵਧੀਆ ਹੀ ਬਣ ਚੁੱਕਿਆ ਹੈ ਭੰਗੜੈ ਐਰੋਬਿਕਸ ਬਹੁਤ ਵਧੀਆ ਹੁਣ ਨਾਲ ਨਾਲ ਬੱਚਿਆਂ ਲਈ ਇੱਕ ਤਰ੍ਹਾਂ ਦੀ ਐਕਸਸਾਈਜ਼ ਵੀ ਹੋ ਜਾਂਦੀ ਹੈ ਭੰਗੜਾ ਐਰੋਬਿਕਸ ਇਹ ਨਵੀਂ ਨਵੀਂ ਤਕਨੀਕ ਹੈ ਇਹ ਭੰਗੜਾ ਐਰੋਬਿਕਸ ਅੱਜ ਕੱਲ੍ਹ ਜਾਂ ਇੱਕ ਤਰ੍ਹਾਂ ਦਾ ਤਹਿਲਕਾ ਹੀ ਮਚਾਇਆ ਹੋਇਆ ਭੰਗੜਾ ਐਰੋਬਿਕਸ ਬੱਚੇ ਨੂੰ ਬਹੁਤ ਜ਼ਿਆਦਾ ਹੀ ਪਸੰਦ ਹੈ ਭੰਗੜਾ ਐਰੋਬਿਕਸ ਸਾਡੇ ਬੱਚਿਆ ਦੇ ਮਨ ਨੂੰ ਭਾਇਆ ਹੋਇਆ ਹੈ ਭੰਗੜਾ ਇਸ ਨੂੰ ਕਰਨ ਨਾਲ ਇੱਕ ਤਰ੍ਹਾਂ ਸਾਰੇ ਸਰੀਰ ਦੇ ਵਿੱਚ ਹਲਚਲ ਹੁੰਦੀ ਹੈ ਧੰਨਵਾਦ